ਅੱਜ ਤੋਂ ਦੋ ਚਾਰ ਦਿਨ ਪਹਿਲਾਂ ਮੈਨੂੰ ਇੱਕ ਫਿਲਮ ਸਕਰੀਨਿੰਗ ਲਈ ਸੱਦਾ ਪੱਤਰ ਮਿਲਿਆ ਹੈ ਅਤੇ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਆਪ ਜੀ ਨੇ ਮੈਨੂੰ ਇਹ ਅਪਰਚੁਨਟੀ ਮੈਨੂੰ ਦਿੱਤੀ ਮੈਂ ਬਹੁਤ ਆਪਣੇ ਆਪ ਵਿੱਚ ਬਹੁਤ ਮਾਣ ਕਰਦੀ ਹਾਂ ਕਿ ਮੈਨੂੰ ਇਹ ਅਪਰਚੁਨਿਟੀ ਤੁਸੀਂ ਦਿੱਤੀ ਹੈ ਤੁਸੀਂ ਮੇਰੇ 'ਚ ਬਹੁਤ ਗੁਣ ਦੇਖੇ ਹੋਣਗੇ ਜੋ ਕਿ ਤੁਹਾਨੂੰ ਵਧੀਆ ਲੱਗੇ ਹਨ ਇਸਤੋਂ ਤਾਂ ਅਤੇ ਤੁਸੀਂ ਮੈਨੂੰ ਇਹ ਸੱਦਾ ਪੱਤਰ ਦਿੱਤਾ ਹੈ ਪਰ ਇਸ ਫਿਲਮ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਮੈਨੂੰ ਹੋਰ ਵੀ ਬਹੁਤ ਜਾਣਕਾਰੀ ਦੀ ਜ਼ਰੂਰਤ ਹੈ ਕਿਉਂਕਿ ਮੈਨੂੰ ਇਸ ਫਿਲਮ ਵਿੱਚ ਕੁਝ ਵੀ ਸਮਝ ਨਹੀਂ ਆ ਰਿਹਾ ਜਿਸ ਨਾਲ ਮੈਂ ਮੇਰਾ ਮਨ ਉਹ ਹੋਰ ਹੋ ਰਿਹਾ ਹੈ ਕਿ ਮੈਂ ਫਿਲਮ ਨਾ ਦੇਖਾਂ ਇਸ ਲਈ ਮੈਨੂੰ ਹੋਰ ਵੀ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੈ ਅਤੇ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਅਤੇ ਇਸ ਫਿਲਮ ਸਕਰੀਨਿੰਗ ਲਈ ਮੈਂ ਬਹੁਤ ਦਿਲਚਸਪ ਹਾਂ ਕਿਉਂਕਿ ਮੈਨੂੰ ਫਿਲਮਾਂ ਦੇਖਣ ਬਾਰੇ ਬਹੁਤ ਵਧੀਆ ਲੱਗਦਾ ਹੈ ਮੈਨੂੰ ਫਿਲਮਾਂ ਦੇਖਣੀਆਂ ਬਹੁਤ ਲਬ ਮੈਨੂੰ ਆਪ ਦੀ ਇੰਟਰਟੇਨਮੈਂਟ ਕਰਨ ਦਾ ਸਾਧਨ ਲੱਗਦਾ ਹੈ ਫਿਲਮਾਂ ਇੱਕ ਅਤੇ ਮੈਂ ਇਹ ਫੈਸਲਾ ਕਰਦੀ ਹਾਂ ਕਿ ਤੁਸੀਂ ਮੈਨੂੰ ਇੱਕ ਫਿਲਮ ਦਾ ਸਿਰਲੇਖ ਸੰਕੇਤ ਮਿਤੀ ਸਮਾਂ ਜਾਂ ਸਥਾਨ ਲਈ ਵੇਰਵੇ ਦੇ ਸਕਦੇ ਹੋ ਕੀ ਤਾਂ ਕਿ ਮੈਂ ਇਸ ਫਿਲਮ ਨੂੰ ਦੇਖਣ ਵਿੱਚ ਹੋਰ ਆਪਣੀ ਹੋਰ ਦਿਲ ਦਿਲਚਸਪੀ ਦਿਖਾ ਸਕਾਂ ਅਤੇ ਤੁਹਾਨੂੰ ਵੀ ਪ੍ਰਮੋਸ਼ਨ ਕਰਨ ਦਾ ਬਹੁਤ ਵਧੀਆ ਤਰੀਕਾ ਮਿਲ ਸਕਦਾ ਹੈ ਜਿਸ ਨਾਲ ਅਸੀਂ ਆਪਣੇ ਵਿੱਚ ਉਹ ਬਣਾ ਕੇ ਸੰਤੁਲਣ ਬਣਾ ਕੇ ਆਪਾਂ ਬਹੁਤ ਵਧੀਆ ਆਪਾਂ ਪ੍ਰੋਫਿਟ ਹਾਸਿਲ ਕਰ ਸਕਦੇ ਹਾਂ